ਮੈਂ ਆਪਣੇ ਵਿਲੱਖਣ ਅਨੁਭਵ ਦਾ ਵਰਣਨ ਕਰਾਂ ਤਾਂ ਮੈਨੂੰ ਮਤਲਬ ਬਹੁਤ ਕੁਝ ਸਿੱਖਣ ਨੂੰ ਬਾਹਰਲੇ ਲੋਕਾਂ ਤੋਂ ਮਿਲਦਾ ਹੈ ਪਰ ਮੈਂ ਇਹ ਗੱਲ ਕਰਨਾ ਚਾਹੁੰਦੀ ਕਿ ਮੇਰਾ ਇੱਕ ਫਰੈਂਡ ਸੀ ਜੋ ਕਿ ਬਾਹਰ ਤੋਂ ਆਇਆ ਅਤੇ ਉਸਨੇ ਮੈਨੂੰ ਫ਼ੋਨ ਕੀਤਾ ਕਿ ਮੈਂ ਇੱਦਾਂ ਪੰਜਾਬ ਘੁੰਮਣਾ ਚਾਹੁੰਦਾ ਵਾ ਅਤੇ ਅਸੀਂ ਉਸਨੂੰ ਏਅਰਪੋਰਟ ਤੋਂ ਪਿੱਕ ਕਰਨ ਗਏ ਉਹ ਜਦ ਸਾਡੇ ਵਿੱਚ ਰਿਹਾ ਸਾਨੂੰ ਬਾਹਰ ਦੀਆਂ ਗੱਲਾਂ ਬਾਰੇ ਉਨ੍ਹਾਂ ਨੇ ਦੱਸਿਆ ਬਾਹਰ ਦੇ ਲੋਕਾਂ ਬਾਰੇ ਦੱਸਿਆ ਤਾਂ ਸਾਡੀ ਸਾਡਾ ਵੈਸੇ ਵੀ ਜਿਹੜਾ ਅਨੁਭਵ ਸੀ ਉਹ ਥੋੜ੍ਹਾ ਪੋਜ਼ੀਟਿਵ ਹੋ ਗਿਆ ਨਾ ਤਾਂ ਉਹ ਸਾਡੇ ਕੋਲ ਜਦ ਆਇਆ ਸੀ ਤਾਂ ਉਸਨੇ ਫਸਟ ਇਹ ਡਿਮਾਂਡ ਰੱਖੀ ਸੀ ਕਿ ਅਸੀਂ ਦਰਬਾਰ ਸਾਹਿਬ ਘੁੰਮਣ ਜਾਣਾ ਕਿ ਉਹਦੀ ਇਹ ਥਿੰਕਿੰਗ ਨੂੰ ਲੈ ਕੇ ਅਸੀਂ ਚਲੋ ਚਲੇ ਗਏ ਉੱਥੇ ਅਸੀਂ ਘੁੰਮੇ ਫਿਰੇ ਉਹਨੇ ਬਹੁਤ ਸਾਰੀਆਂ ਆਪਣੀਆਂ ਜਿਹੜੀਆਂ ਚੀਜ਼ਾਂ ਸੀ ਸਾ ਗੱਲਾਂ ਸੀ ਸਾਡੇ ਨਾਲ਼ ਸ਼ੇਅਰ ਕੀਤੀਆਂ ਨਾ ਸਾਡਾ ਸਾਡਾ ਅਨੁਭਵ ਨੂੰ ਹੋਰ ਅਸੀਂ ਅਸੀਂ ਬਹੁਤ ਕੁਛ ਉਹਦੇ ਤੋਂ ਸਿੱਖਿਆ ਅਤੇ ਬਹੁਤ ਕੁਛ ਉਹਨਾਂ ਨੂੰ ਵੀ ਸਾਡੇ ਤੋਂ ਸਿੱਖਣ ਨੂੰ ਮਿਲਿਆ ਅਤੇ ਅਲੱਗ ਅਲੱਗ ਤਰ੍ਹਾਂ ਦਾ ਸਾਨੂੰ ਮਤਲਬ ਪੋਜ਼ੀਟੀਵਿਟੀ ਉਹਨਾਂ ਤੋਂ ਮਿਲੀ